ਹੈਲੋ ਤੁਸੀਂ ਤੁਸੀਂ ਮੁਖਤਿਆਰ ਸਬਜ਼ੀ ਵਾਲੇ ਬੋਲ ਰਹੇ ਹੋ ਅਸੀਂ ਸਾਡੀ ਕੁੜੀ ਦਾ ਵਿਆਹ ਹੈ ਅਸੀਂ ਤੁਹਾਡੇ ਤੋਂ ਵਗੈਰ ਸਪਰੇ ਅਤੇ ਨੈਚੁਰਲ ਸਬਜ਼ੀ ਚਾਹੁੰਦੇ ਹਨ ਤੁਹਾਡੇ ਕੋਲ ਸਾਰੀਆਂ ਸਬਜ਼ੀਆਂ ਹਨ ਕੀ ਅਸੀਂ ਤੁਹਾਡੇ ਕੋਲ ਸਬਜ਼ੀ ਖਰੀਦਣ ਲਈ ਕੁਛ ਦਿਨ ਬਾਅਦ ਪੈਸੇ ਦੇ ਸਕਦੇ ਹਨ ਇਸ ਲਈ ਅਸੀਂ ਉਹਦੇ ਤੋਂ ਉਮੀਦ ਰੱਖਦੇ ਹਨ ਕਿ ਤੁਸੀਂ ਸਾਨੂੰ ਜਾਇਜ ਪੈਸੇ ਲਾ ਕੇ ਸਪਰੇ ਔਰ ਦਵਾਈਆਂ ਤੋਂ ਰਹਿਤ ਸਬਜ਼ੀ ਦਿਓਗੇ ਹਾਂਜੀ ਤੋ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਜੀ ਓਕੇ